ਹਾਂਜੀ ਮੇਰੇ ਕੋਲ ਹਾਂ ਦੋ ਤਿੰਨ ਮੱਝਾਂ ਗਾਵਾਂ ਮੈਂ ਰੱਖੀਆਂ ਹੋਈਆਂ ਪਸ਼ੂ ਰੱਖੇ ਹੋਏ ਨੇ ਤਾਂ ਜਿਹੜਾ ਕਿ ਮੈਂ ਬੜੇ ਹੀ ਸ਼ੌਂਕ ਦੇ ਨਾਲ ਉਹਨਾਂ ਦੀ ਦੇਖਭਾਲ ਕਰਦਾ ਗਾ ਅਤੇ ਜਦੋਂ ਵੀ ਸਾਡੇ ਪਸ਼ੂ ਸੂੰਦਾ ਹੈਗਾ ਮੱਝ ਨੂੰ ਨਾ ਜਦੋਂ ਕੋਈ ਕੱਟੀ ਜਾਂ ਕੱਟਾ ਕੋਈ ਹੁੰਦਾ ਗਾ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਉਹਦੇ ਮੂੰਹ ਦੇ ਵਿੱਚ ਜਾਲੇ ਸਾਫ ਕਰਕੇ ਹੈ ਨਾ ਅਤੇ ਉਹਦਾ ਸਾਰਾ ਸਾਫ ਕਰਦੇ ਕੁਛ ਤਾਂ ਮੱਝ ਕਰ ਦਿੰਦੀ ਆ ਮੂੰਹ 'ਚੋਂ ਜਾਲੇ ਵਗੈਰਾ ਉਹ ਆਪ ਨੂੰ ਕੱਢਣੇ ਪੈਂਦੇ ਆ ਅਤੇ ਗੁੜ ਨੂੰ ਪੋਲਾ ਕਰਕੇ ਉਹਦੀਆਂ ਖਾਲਾ ਕ ਦੇ ਵਿੱਚ ਗੁੜ ਲਾਇਆ ਜਾਂਦਾ ਹੈਗਾ ਤਾਂ ਕਿ ਜਿਹੜਾ ਕੀ ਆ ਉਹ ਆਪਦਾ ਮੂੰਹ ਆ ਚਲਾਉਂਦਾ ਰਹੇ ਕਿਉਂਕਿ ਥੋੜ੍ਹੇ ਟਾਈਮ ਬਾਅਦ 'ਚ ਉਹਨੂੰ ਦੁੱਧ ਚੁੰਗਣ ਦੇ ਲਈ ਤਿਆਰ ਹੋਣਾ ਹੁੰਦਾ ਓਹ ਬੱਚੇ ਨੇ ਅਤੇ ਨਹੀਂ ਜੇ ਆਪਾਂ ਉਹਦੇ ਮੂੰਹ ਦੇ ਵਿੱਚ ਗੁੜ ਨਹੀਂ ਪਾਵਾਂਗੇ ਤਾਂ ਉਹਦੀਆਂ ਬਾਚੀਆਂ ਮਰ ਜਾਂਦੀਆਂ ਹੈਗੀਆਂ ਤਾਂ ਇਸ ਨੇ ਜਿਹੜਾ ਕਿ ਸਭ ਤੋਂ ਪਹਿਲਾਂ ਸਾਨੂੰ ਤਾਂ ਗੁੜ ਲਾਉਣਾ ਚਾਹੀਦਾ ਹੈਗਾ ਨਾ ਫਿਰ ਹੌਲੀ ਹੌਲੀ ਉਹਨੂੰ ਹਵਾ ਲੱਗਦੀ ਤਾਂ ਉਹ ਖੜ੍ਹਾ ਹੁੰਦਾ ਡਿੱਗਦਾ ਸਾਨੂੰ ਉਹਦੀ ਨਿਗ੍ਹਾ ਰੱਖਣੀ ਪੈਂਦੀ ਹੈ ਚਲ ਉਸ ਤੋਂ ਬਾਅਦ ਦੋ ਘੰਟਿਆਂ ਬਾਅਦ ਤੁਰਨ ਦੇ ਯੋਗ ਹੋ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਬੋਹਲਾ ਪਿਆਉਂਦੇ ਹੈਗੇ ਬੋਹਲਾ ਪਹਿਲਾਂ ਤਾਂ ਮਸਾਂ ਫੜਦਾ ਉਹ ਥਣ ਹੌਲੀ ਹੌਲੀ ਥਣ ਫੜ ਕੇ ਉਹਨੂੰ ਬੋਹਲਾ ਪਿਆ ਕੇ ਨਾ ਪਹਿਲਾਂ ਬੋਹਲਾ ਪੀ ਕੇ ਫਿਰ ਉਹ ਪਹਿਲਾਂ ਡਾਸਾ ਕਰਦਾ ਹੈਗਾ ਗੋਹਾ ਗੋਹਾ ਬੋਲਦੇ ਬਟ ਉਹਨੂੰ ਕੱਟੇ ਪਹਿਲਾਂ ਡਾਸਾ ਹੀ ਕਹਿੰਦੇ ਹਾਂ ਅਸੀਂ ਇੱਧਰ ਤਾਂ ਉਹ ਡਾਸਾ ਕਰਦਾ ਹੈਗਾ ਉਹ ਡਾਸੇ ਨਾਲ ਕੀ ਆ ਸਾਰਾ ਉਹਦਾ ਗੰਦ ਮਿੰਦ ਬਾਹਰ ਆ ਜਾਂਦਾ ਹੈਗਾ ਫਿਰ ਉਸ ਤੋਂ ਬਾਅਦ ਕੀ ਆ ਦੋ ਤਿੰਨ ਦਿਨ ਵੀ ਵਧੀਆ ਉਹ ਦੁੱਧ ਚੁੰਘਦਾ ਹੈਗਾ ਦੋ ਟਾਈਮ ਵਧੀਆ ਉਹਨੂੰ ਦੁੱਧ ਪਿਲਾਉਂਦੇ ਹਾਂ ਅਤੇ ਆਹ ਸ਼ਾਮ ਵੇਲੇ ਗੁੜ ਜ਼ਰੂਰ ਅਸੀਂ ਉਹਦੇ ਆਪਣੇ ਲਾਉਣੇ ਹੈਗੇ ਗੁੜ ਵਗੈਰਾ ਲਗਾ ਕੇ ਉਹਨੂੰ ਐਂ ਵਧੀਆ ਬੰਨ੍ਹ ਦਿੰਦੇ ਆ ਜਿਵੇਂ ਹੁਣ ਠੰਡ ਆ ਆਥਣੇ ਬੋਰੀ ਬੰਨ ਦਾਂਗੇ ਅਤੇ ਆਪਾਂ ਨਾਲੇ ਗੁੜ ਖਵਾਵਾਂਗੇ ਨਾਲੇ ਬੋਰੀ ਬੰਨ੍ਹ ਦਾਂਗੇ ਜਦੋਂ ਪੰਦਰ੍ਹਾਂ ਕੁ ਦਿਨਾਂ ਦਾ ਹੋ ਜਾਂਦਾ ਤਾਂ ਮਤਲਬ ਭਾ ਵਾਲੀ ਨਹੀਂ ਇੱਕ ਦਵਾਈ ਆਉਂਦੀ ਹੈਗੀ ਠੀਕ ਆ ਜੀ ਉਹ ਦਵਾਈ ਅਸੀਂ ਤੀਹ ਐਮ ਐਲ ਦਿੰਦੇ ਹਾਂ ਉਹਨੂੰ ਅੱਠ ਅੱਠ ਦਿਨਾਂ ਦੇ ਫਰਕ ਦੇ ਨਾਲ ਦੇ ਦਿੰਦੇ ਹਾਂ ਉਹਦੇ ਨਾਲ ਕਿ ਮਲੱਪ ਵਗੈਰਾ ਨਹੀਂ ਗੇ ਪੈਂਦੇ ਅਤੇ ਡੱਕਵਾਂ ਦੁੱਧ ਛੱਡਦੇ ਆ ਅਤੇ ਫਿਰ ਉਹਨੂੰ ਖੁੱਲ੍ਹਾ ਵੀ ਛੱਡਦੇ ਆ ਤਾਂ ਕਿ ਭੱਜੇ ਅਤੇ ਉਹਦੇ ਕੀ ਹੈਗਾ ਆਪਣਾ ਵੀ ਭੱਜ ਕੇ ਉਹਦੇ ਦੁੱਧ ਵਗੈਰਾ ਹਜਮ ਆਜੇ ਫਿਰ ਦੁਪਹਿਰ ਵੇਲੇ ਲੱਸੀ ਦੇ ਵਿੱਚ ਸਰ੍ਹੋਂ ਦਾ ਤੇਲ ਅਤੇ ਨਮਕ ਪਾ ਕੇ ਵੀ ਉਹਨੂੰ ਅਸੀਂ ਪਿਆਉਂਦੇ ਹੈਗੇ ਬਾਕੀ ਦੁੱਧ ਫੁੱਲ ਛੱਡੀ ਦਾ ਹੈਗਾ ਅਤੇ ਐਂ ਪੂਰਾ ਵਧੀਆ ਹੱਥ ਹੁੱਥ ਮਾਰ ਕੇ ਪਲੋਸੀ ਦਾ ਹੈਗਾ ਉਹਦੇ ਨਾਲ ਜਾਨਵਰਾਂ ਨਾਲ ਮੋਹ ਪਿਆਰ ਵੀ ਵੱਧਦਾ ਹੈਗਾ ਅਤੇ ਉਹ ਆਪ ਵੀ ਤੰਦਰੁਸਤ ਰਹਿੰਦਾ ਹੈਗਾ ਜਾਨਵਰ ਆਪਣਾ